ਪੰਜਾਬੀ ਭਾਸ਼ਾ ਦਿਨੋਂ ਬਰ ਦਿਨ ਵੱਧਦੀ ਜਾ ਰਹੀ ਹੈ ਪੰਜਾਬੀ ਭਾਸ਼ਾ ਭਾਰਤ ਵਿੱਚ ਤਾਂ ਬੋਲੀ ਜਾ ਰਹੀ ਹੈ ਪਰ ਹੁਣ ਅਸੀਂ ਦੇਖ ਸਕਦੇ ਹਾਂ ਕਿ ਹਰ ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਹੋ ਰਹੀ ਹੈ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਪੰਜਾਬੀ ਭਾਸ਼ਾ ਤਾਂ ਲਾਜ਼ਮੀ ਹੈ ਅਤੇ ਇਸ ਤੋਂ ਇਲਾਵਾ ਬਾਹਰ ਵੀ ਈ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਹੋ ਰਹੀ ਹਨ ਜਿਵੇਂ ਕਿ ਕਨੇਡਾ ਵਿੱਚ ਜਿਹੜੀ ਉਨ੍ਹਾਂ ਦੀ ਸੈਕਿੰਡ ਲੈਂਗੁਏਜ਼ ਹੈ ਉਹ ਪੰਜਾਬੀ ਹੈ ਗੋਰੇ ਵੀ ਇਸ ਨੂੰ ਸਿੱਖ ਰਹੇ ਹਨ